ਇਸ ਗੱਲ ਵਿੱਚ ਤਾਂ ਪੂਰੀ ਸੱਚਾਈ ਹੈ ਕਿ ਰਾਜਨੀਤਿਕ ਤਣਾਅ ਬਣਾਉਣ ਲਈ ਹਰ ਕੋਈ ਧਰਮ ਦਾ ਸਪੋਰਟ ਸਹਾਰਾ ਲੈਂਦਾ ਹੈ ਰਾ ਧਰਮ ਵਿੱਚ ਦੰਗੇ ਕਰਵਾਉਂਦਾ ਹੈ ਜਿਸਦੇ ਹੱਥ ਵਿੱਚ ਪਾਵਰ ਆ ਜਾਂਦੀ ਆ ਉਹ ਕਦੇ ਨਹੀਂ ਚਾਹੁੰਦਾ ਕਿ ਮੈਂ ਆਪਣੀ ਕੁਰਸੀ ਛੱਡਾਂ ਆਪਣੀ ਪਾਵਰ ਛੱਡਾਂ ਇਸ ਲਈ ਉਹ ਧਰਮ ਨੂੰ ਧਰਮ ਦੇ ਲੋਕਾਂ ਨੂੰ ਆਪਸ ਵਿੱਚ ਲੜਾਉਂਦਾ ਰਹਿੰਦਾ ਹੈ ਉਹਨਾਂ ਨੂੰ ਧਰਮ ਤੋਂ ਬਾਹਰ ਨਹੀਂ ਨਿਕਲ਼ ਦੇਣਾ ਚਾਹੁੰਦਾ ਉਹ ਚਾਹੁੰਦੇ ਹਨ ਕਿ ਲੋਕ ਇਸੀ ਜੰਜਾਲ਼ ਵਿੱਚ ਫਸੇ ਰਹਿਣ ਉਹ ਵੀ ਸਾਨੂੰ ਵਿਹਲੇ ਹੋ ਕੇ ਸਾਨੂੰ ਸਵਾਲ ਨਾ ਪੁੱਛ ਸਕਣ ਵੀ ਤੁਸੀਂ ਸਾਡੇ ਲਈ ਕੀ ਕਰਦੇ ਹੋ ਕੀ ਸਾਡੇ ਲਈ ਚੰਗਾ ਕੀ ਮਾੜਾ ਇਸ ਲਈ ਜਿਹੜਾ ਰਾਜਨੀਤਿਕ ਬੰਦਾ ਆਪਣੇ ਕੁਰਸੀ ਦੇ ਲਾਲਚ ਨੂੰ ਹਮੇਸ਼ਾਂ ਲੋਕਾਂ ਨੂੰ ਆਪਸ ਵਿੱਚ ਲੜਾਉਂਦਾ ਹੀ ਰਹਿੰਦਾ ਉਹ ਕੋਈ ਨਾ ਕੋਈ ਬਹਾਨਾ ਲੱਭਦਾ ਹੀ ਰਹਿੰਦਾ ਵੀ ਜਿਹੜਾ ਲੋਕਾਂ ਨੂੰ ਵਿਅਸਤ ਰੱਖਿਆ ਜਾਵੇ ਉਹਨਾਂ ਨੂੰ ਮਾਇੰਡ ਵੱਲੋਂ ਫਰੀ ਨਾ ਕਰਿਆ ਜਾਵੇ ਦਿਮਾਗ ਵੱਲੋਂ ਵੀ ਜਿਹੜੇ ਸਾਨੂੰ ਆ ਕੇ ਸਵਾਲ ਜਵਾਬ ਕਰ ਸਕਣ